ਹਾਂਜੀ ਪੰਜਾਬ ਦੇ ਵਿੱਚ ਕਾਫ਼ੀ ਸਿੱਖਿਆ ਕੇਂਦਰ ਹਨ ਜਿਵੇਂ ਪੀ ਟੀ ਓ ਹੋ ਗਈ ਪੰਜਾਬ ਯੂਨੀਵਰਸਿਟੀ ਹੋ ਗਈ ਜੀ ਐੱਨ ਡੀ ਯੂ ਹੋ ਗਈ ਇਹਦੇ ਵਿੱਚ ਕਾਫ਼ੀ ਕੋਰਸਿਸ ਜੋ ਹੈ ਹੁਣ ਇਸ ਟਾਈਮ ਜੋ ਅਵੇਲੇਬਲ ਹਨ ਜਿਹੜੀ ਲੋਕ ਆਰਾਮ ਦੇ ਨਾਲ ਜਿਹੜੇ ਕਰ ਸਕਦੇ ਹਨ ਅਤੇ ਆਪਣੀ ਜੀਵਨ ਸ਼ੈਲੀ ਨੂੰ ਅੱਗੇ ਵਧਾ ਸਕਦੇ ਹਨ ਪਹਿਲਾਂ ਤਾਂ ਯੂਨੀਵਰਸਿਟੀ ਦੇ ਵਿੱਚ ਸਿਰਫ਼ ਸਿੱਖਿਆ ਤੱਕ ਹੀ ਸੀ ਹੁਣ ਹੋਰ ਚੀਜ਼ਾਂ ਵੀ ਜਿਵੇਂ ਹੋਰ ਕੋਰਸ ਵੀ ਆ ਗਏ ਨੇ ਜਿਵੇਂ ਕੋਈ ਸਿਲਾਈ ਦਾ ਹੋ ਗਿਆ ਬੂਟੀਸ਼ੀਅਨ ਦਾ ਹੋ ਗਿਆ ਕਿ ਜੋ ਸਿ ਅ ਸਲਾ ਅ ਜੋ ਲੋਕੀਂ ਆਪਣੇ ਪੜ੍ਹਾਈ ਪੱਧਰ 'ਤੇ ਆਪਣੇ ਆਪ ਨੂੰ ਉੱਪਰ ਲੈ ਕੇ ਨਹੀਂ ਜਾ ਸਕਦੇ ਉਹ ਲੋਕੀਂ ਆਪਣੇ ਆਪ ਨੂੰ ਖੇਡਾਂ 'ਤੇ ਹੋ ਗਏ ਸਿਲਾਈ ਬੁਣਾਈ 'ਚ ਇਹਨਾਂ 'ਚ ਅੱਗੇ ਜਾ ਸਕਦੇ ਹਨ ਇਸ ਨਾਲ ਰਿਲੇਟਿਡ ਕਾਫ਼ੀ ਕੋਰਸ ਜੋ ਹੈ ਹੁਣ ਪੰਜਾਬ ਦੇ ਵਿੱਚ ਖੁੱਲ੍ਹ ਗਏ ਹਨ ਇਹ ਸਿੱਖਿਆ ਕੇਂਦਰ ਜੋ ਹੈ ਸਾਡੇ ਲਈ ਬਹੁਤ ਵਧੀਆ ਹਨ ਤਾਂ ਜੋ ਲੋਕਾਂ ਦਾ ਜੀਵਨ ਜੋ ਹੈ ਅੱਗੇ ਵੱਧ ਰਿਹਾ ਹੈ ਲੋਕੀਂ ਵਧੀਆ ਵਧੀਆ ਚੀਜ਼ਾਂ ਜੋ ਸਿੱਖ ਰਹੇ ਹਨ ਅਤੇ ਇਸ ਨੂੰ ਲੈ ਕੇ ਜੋ ਹੈ ਅੱਗੇ ਵੱਧ ਰਹੇ ਹਨ